ਮੈਂ ਸ਼ਹਿਰ ਵਿੱਚ ਰਹਿੰਦੀ ਹਾਂ ਅਤੇ ਕਈ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਸਿਹਤ ਸੰਭਾਲ ਖੇਤਰ ਦੇ ਵਿੱਚ ਇਸ ਖੇਤਰ ਦੇ ਵਿੱਚ ਸ਼ਹਿਰੀ ਅਤੇ ਪੇਂਡੂ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੀ ਸੰਭਾਲ ਖੇਤਰ 'ਚ ਫ਼ਰਕ ਹੈ ਪਿੰਡਾਂ ਵਿੱਚ ਜਿਹੜੇ ਬਹੁਤ ਸਾਰੇ ਸਰਕਾਰੀ ਹੋਸਪਿਟਲ ਵਾਲ ਵੀ ਹੈਗੇ ਆ ਉਹ ਇੰਨੀ ਜ਼ਿਆਦਾ ਸੁਵਿਧਾਵਾਂ ਨਹੀਂ ਉੱਥੇ ਮਿਲਦੀਆਂ ਹਨ ਉੱਥੇ ਬਹੁਤ ਜ਼ਿਆਦਾ ਡੋਕਟਰ ਨਹੀਂ ਮਿਲਦੇ ਹਨ ਉੱਥੇ ਬਹੁਤ ਜ਼ਿਆਦਾ ਨਰਸਾਂ ਨਹੀਂ ਮਿਲਦੀਆਂ ਹਨ ਉੱਥੇ ਬਹੁਤ ਜ਼ਿਆਦਾ ਸਰਕਾਰੀ ਹਸਪਤਾਲਾਂ ਦੀ ਸਫਾਈ ਨਹੀਂ ਹੁੰਦੀ ਹੈ ਜਿਹਦੇ ਕਾਰਨ ਸ਼ਹਿਰਾਂ ਦੇ ਵਿੱਚ ਤੇ ਫਿਰ ਵੀ ਲੋਕੀ ਦੇ ਜਿਹੜੇ ਹਸਪਤਾਲ ਹਨ ਜਿੱਦਾ ਗੁਰੂ ਨਾਨਕ ਹੋਸਪਿਟਲ ਹੋ ਗਿਆ ਹਸਪਤਾਲ ਹੋ ਗਿਆ ਇਹਨਾਂ ਹਸਪਤਾਲਾਂ ਦੇ ਵਿੱਚ ਸਰਕਾਰੀ ਜਿਹੜੇ ਵੀ ਹਸਪਤਾਲ ਹਨ ਉਹਨਾਂ ਵਿੱਚ ਬੜਾ ਫ਼ਰਕ ਪਾਇਆ ਜਾਂਦਾ ਹੈ ਇਹਨਾਂ ਹਸਪਤਾਲਾਂ ਵਿੱਚ ਡਾਕਟਰ ਵੀ ਟਾਇਮ ਸਮੇਂ ਸਿਰ ਆਉਂਦੇ ਸਮੇਂ ਅਨੁਸਾਰ ਆਉਂਦੇ ਹਨ ਅਤੇ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਹਨ ਪਿੰਡਾਂ ਦੇ ਵਿੱਚ ਲੋਕ ਡਾਕਟਰ ਵੀ ਟਮ ਸਮੇਂ ਅਨੁਸਾਰ ਨਹੀਂ ਆਉਂਦੇ ਹਨ ਕਿਉਂਕਿ ਕਈ ਲੋਕ ਪਿੰਡਾਂ ਦੇ ਵਿੱਚ ਜਿਹੜੇ ਡਾਕਟਰ ਹਨ ਉਹ ਸ਼ਹਿਰਾਂ ਵਿੱਚ ਰਹਿੰਦੇ ਹਨ ਅਤੇ ਉਹਨਾਂ ਨੂੰ ਜਦੋਂ ਪਿੰਡਾਂ ਤੱਕ ਪਹੁੰਚਦੇ ਹਨ ਕਈ ਵਾਰੀ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਅਤੇ ਕਈ ਕਈ ਕਈ ਦਿਨ ਤਾਂ ਉਹ ਜਿੱਦਾਂ ਹੁਣ ਕਈ ਵਾਰੀ ਸਰਦੀਆਂ ਆ ਜਾਂਦੀਆਂ ਹਨ ਤਾਂ ਧੁੰਦਾ ਪੈ ਜਾਂਦੀਆਂ ਹਨ ਅਤੇ ਉਹ ਡਾਕਟਰਾਂ ਨੂੰ ਪਿੰਡਾਂ ਦੇ ਵਿੱਚ ਜਾਣਾ ਬਹੁਤ ਹੀ ਔਖਾ ਲੱਗਦਾ ਹੈ ਸਿਹਤ ਸੰਭਾਲ ਖੇਤਰ ਦੇ ਵਿੱਚ ਪਿੰਡ ਉਹ ਥੋੜ੍ਹਾ ਪਿਛੜਾ ਹੋਇਆ ਖੇਤਰ ਮੰਨਿਆ ਜਾਂਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਜਿਹੜੇ ਬਿਮਾਰੀਆਂ ਤਾਂ ਉਹੀ ਹੁੰਦੀਆਂ ਹਨ ਪਰ ਡਾਕਟਰ ਨਹੀਂ ਮਿਲਦੇ ਦਵਾਈਆਂ ਨਹੀਂ ਮਿਲਦੀਆਂ ਉਹਨਾਂ ਦੇ ਇਲਾਜ ਲਈ ਐਕਸਰੇ ਵਗੈਰਾ ਜਿਹੜੇ ਆ ਮਸ਼ੀਨਾਂ ਵਗੈਰਾ ਹੁੰਦੀਆਂ ਹਨ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰਦੀਆਂ ਹਨ ਅਤੇ ਉੱਥੇ ਜਾ ਕੇ ਡਾਕਟਰ ਵੀ ਜਲਦੀ ਜਲਦੀ ਨਹੀਂ ਪਹੁੰਚ ਪਾਉਂਦੇ ਉਹਨਾਂ ਦੇ ਬਹੁਤ ਵੱਡੇ ਹਸਪਤਾਲ ਵੀ ਨਹੀਂ ਹੁੰਦੇ ਬਣੇ ਹੋਏ ਹੁੰਦੇ ਚਾਹੇ ਛੋਟੇ ਬਣੇ ਹੋਣ ਪਰ ਇੰਨਾ ਤਾਂ ਹੋਣਾ ਚਾਹੀਦਾ ਕਿ ਸਿਹਤ ਸੰਭਾਲ ਨੇ ਉਹਨਾਂ ਨੂੰ ਸਿਹਤਾਂ ਲਈ ਉਹਨਾਂ ਨੂੰ ਡਾਕਟਰਾਂ ਨੇ ਪੂਰੀ ਸਮੇਂ ਸਿਰ ਉਪਲਬਧ ਤਾਂ ਹੋਣੇ ਚਾਹੀਦੇ ਆ ਪਰ ਉਹ ਪਿੰਡਾਂ ਦੇ ਵਿੱਚ ਨਹੀਂ ਹਨ ਸ਼ਹਿਰਾਂ ਦੇ ਵਿੱਚ ਤਾਂ ਡਾਕਟਰ ਬੜੇ ਆਸਾਨੀ ਦੇ ਨਾਲ ਸਾਨੂੰ ਮਿਲ ਜਾਂਦੇ ਆ ਅਤੇ ਨਾਲੇ ਜਿਹੜੇ ਸਰਕਾਰੀ ਹਸਪਤਾਲ ਹਨ ਉਹ ਬੜੇ ਹੀ ਚੰਗੇ ਹਨ ਜਿਹ ਜਿਹੜੇ ਪਿੰਡਾਂ ਦੇ ਵਿੱਚ ਉਹ ਇੰਨਾ ਜ਼ਿਆਦਾ ਚੰਗੇ ਹਸਪਤਾਲ ਨਹੀਂ